ਹਾਂਜੀ ਸਾਡੇ ਹਸਪਤਾਲਾਂ 'ਚ ਇਹ ਸਾਰੇ ਟੈਸਟ ਹੁੰਦੇ ਨੇ ਅਤੇ ਕਿਤੇ ਹੋਰ ਜਾਣ ਦੀ ਸਾਨੂੰ ਲੋੜ ਨਹੀਂ ਪੈਂਦੀ ਬਸ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਲੱਗ ਜਾਂਦਾ ਊਂ ਕੋਈ ਪ੍ਰੋਬਲਮ ਨਹੀਂ ਆਉਂਦੀ